ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਮੈਮ ਬਠਿੰਡਾ ਤੋਂ ਬੋਲ ਰਹੇ ਜੀ ਤੁਸੀਂ ਕਾਰਲਸ ਸਪੋਰਟਸ ਕਲੱਬ ਤੋਂ ਮੈਮ ਅਸੀਂ ਝੁੰਗੇ ਬੋਲ ਤੋਂ ਰਹੇ ਹਾਂ ਮੈਮ ਅਸੀਂ ਖੇਡਾਂ ਬਾਰੇ ਨੌਲੇਜ ਲੈਣੀ ਸੀ ਜੀ ਤੁਹਡੇ ਤੋਂ ਤੁਹਾਡੇ ਕੋਚਿੰਗ ਸੈਂਟਰ 'ਚ ਕੋਚਿੰਗ ਲੈਣੀ ਸੀ ਖੇਡਾਂ ਦੀ ਵੀ ਤੁਸੀਂ ਤੁਹਾਡੇ ਸੈਂਟਰ ਵਿੱਚ ਕਿਹੜੀਆਂ ਕਿਹੜੀਆਂ ਖੇਡਾਂ ਦੀ ਕੋਚਿੰਗ ਦਿੱਤੀ ਜਾਂਦੀ ਹੈ ਜੀ ਹਾਂਜੀ ਹੈਂ ਅੱਛਿਆ ਜੀ ਮੈਮ ਅਸੀਂ ਖੇਡਾਂ 'ਚ ਤਾਂ ਕਾਫੀ ਇੰਟਰਸਟ ਰੱਖਦੀ ਹਾਂ ਮੈਂ ਸਟਾਰਟਿੰਗ ਤੋਂ ਹੀ ਖੇਲਦੇ ਆਏ ਹਾਂ ਅਸੀਂ ਤਾਂ ਵੀ ਮਤਲਬ ਮੈਨੂੰ ਆਏ ਹਾਂ ਵੀ ਮੈਂ ਆਪਣੇ ਖੇਡਾਂ 'ਚ ਵੀ ਹੋਰ ਵੀ ਜ਼ਿਆਦਾ ਸੁਧਾਰ ਕਰਨਾ ਚਾਹੁੰਦੀ ਹਾਂ ਵੀ ਮੈਂ ਅੱਗੇ ਪਾਰਟੀਸਪੇਟ ਕਰਨਾ ਚਾਹੁੰਦੀ ਹਾਂ ਇੰਟਰਨੈਸ਼ਨਲ ਪੱਧਰ 'ਤੇ ਜਾਣਾ ਚਾਹੁੰਦੇ ਹਾਂ ਸਟੇਟ ਲੈਵਲ ਤੋਂ ਅਤੇ ਵੀ ਮੈਡਮ ਵੀ ਮੈਂ ਕੋਚਿੰਗ ਲੈਣੀ ਸੀਗੀ ਵੀ ਮੈਨੂੰ ਆਪਣੇ ਆਪ 'ਚ ਥੋੜ੍ਹਾ ਜਿਹਾ ਹਜੇ ਇੰਝ ਲੱਗਦਾ ਹੈ ਵੀ ਮੈਨੂੰ ਹੋਰ ਸੁਧਾਰ ਕਰਨ ਦੀ ਲੋੜ ਹੈ ਮੈਂ ਹੈਂਡਬੋਲ 'ਚ ਇੰਟਰਸਟ ਰੱਖਦੀ ਹਾਂ ਮੈਡਮ ਮੈਂ ਤੁਹਾਡੇ ਕੋਲੇ ਹੈਂਡਬੋਲ ਦੀ ਕੋਚਿੰਗ ਲੈਣੀ ਸੀ ਵੀ ਕਿ ਆਪਣੀ ਫੀਸ ਵਗੈਰਾ ਹੈਗੀ ਆ ਜੀ ਮੈਮ ਘੱਟ ਨਹੀਂ ਕਰਦੇ ਜੀ ਅਸੀਂ ਘਰੋਂ ਥੋੜ੍ਹੇ ਜਿਹੇ ਵੀਕ ਹਾਂ ਜੀ ਫਾਈਨੈਸ਼ਅਲੀ ਅਤੇ ਵੀ ਇਸ ਕਰਕੇ ਹਾਂਜੀ ਜੀ ਤੁਸੀਂ ਮੈਨੂੰ ਥੋੜ੍ਹਾ ਜਿਹਾ ਆਈਡੀਆ ਦੱਸ ਦਿੰਦੇ ਤਾਂ ਮੈਂ ਆਪਣੇ ਘਰ ਵੀ ਗੱਲ ਕਰਨੀ ਸੀਗੀ ਪਾਪਾ ਨਾਲ ਫਿਰ ਅਸੀਂ ਫਿਰ ਹੀ ਆਵਾਂਗੇ ਤੁਹਾਡੇ ਕੋਲ ਐਡਮਿਸ਼ਨ ਲੈਣ ਵਾਸਤੇ ਜੀ ਠੀਕ ਹੈ ਜੀ ਫਿਰ ਸਾਨੂੰ ਹੋਰ ਲੈਸ ਮਿਲ ਜੂਗਾ ਜੀ ਠੀਕ ਹੈ ਜੀ ਮੈਮ ਹੈਗੇ ਆ ਜੀ ਮੇਰੇ ਨਾਲ ਸਟੂਡੈਂਟ ਤਾਂ ਹੋਰ ਹੈਗੇ ਆ ਜੀ ਤਿੰਨ ਚਾਰ ਜਾਣੇ ਮੈਂ ਉਹਨਾਂ ਨੂੰ ਵੀ ਲੈ ਆਉਂਗੀ ਉਹ ਹੋਰ ਗੇਮਾਂ 'ਚ ਇੰਟਰਸਟਿਡ ਹੈਗੇ ਹੈ ਨਾਲੇ ਠੀ ਠੀਕ ਹੈ ਜੀ ਅਤੇ ਮੈਮ ਵੀ ਇਹ ਸਾਡਾ ਟਾਈਮ ਕੀ ਹੈ ਜੀ ਕੋਚਿੰਗ ਸੈਂਟਰ 'ਤੇ ਆਉਣ ਦਾ ਅਤੇ ਮੈਡਮ ਦੁਪਹਿਰ ਤੋਂ ਬਾਅਦ ਜੀ ਸੁਬਹਾ ਅਸੀਂ ਕੋਲਜ ਜਾਣਾ ਹੁੰਦਾ ਜੀ ਜੇ ਇੱਕ ਵਜੇ ਤੋਂ ਬਾਅਦ ਜਾਂ ਦੋ ਵਜੇ ਤੋਂ ਬਾਅਦ ਕੋਈ ਟਾਈਮ ਜੀ ਠੀਕ ਹੈ ਜੀ ਚਾਰ ਤੋਂ ਛੇ ਤੱਕ ਜੀ ਕਲਾਸ ਠੀਕ ਹੈ ਜੀ ਠੀਕ ਹੈ ਜੀ ਚਲੋ ਓਕੇ ਮੈਮ ਥੈਂਕ ਯੂ ਜੀ ਓਕੇ ਜੀ ਓਕੇ